ਅਸੀਂ ਸ਼ੁਰੂ ਤੋਂ ਹੀ ਸਕੂਲ ਟੈਮ ਤੋਂ ਆਪਣੀ ਦੌੜ ਲਾਉਂਦੇ ਰਹੇ ਹਾਂ ਪਰ ਸਾਡੇ ਟੀਚਰਾਂ ਨੇ ਸਾਨੂੰ ਬਹੁਤ ਪਰਚਲਤ ਕੀਤਾ ਹੈ ਭਈ ਤੁਸੀਂ ਇਸ ਬਾਰੇ ਸਾਨੂੰ ਪ੍ਰੇਰਨਾ ਕਰਦੇ ਰਹੇ ਹਨ ਕਿ ਤੁਸੀਂ ਦੌੜ ਲਾਓਗੇ ਤਾਂ ਫਿਟਨੈਸ ਰਹੇਗੀ ਤੁਹਾਡੀ ਅਸੀਂ ਉਸ ਤੋਂ ਦਿਨ ਤੋਂ ਲੈ ਕੇ ਹੁਣ ਤੱਕ ਇਸ ਤਰ੍ਹਾਂ ਹੀ ਆਪਣੀ ਫਿਟਨੈਸ ਬਣਾਈ ਹੋਈ ਹੈ ਅਸੀਂ ਆਪਣੇ ਪਿੰਡ ਦੇ ਵਿੱਚ ਇੱਕ ਕਲੱਬ ਬਣਾਇਆ ਹੋਇਆ ਵਾ ਜਿਸ ਵਿੱਚ ਅਸੀਂ ਬਾਰ੍ਹਾਂ ਚੌਦ੍ਹਾਂ ਮੈਂਬਰ ਹੈਗੇ ਹਾਂ ਅਸੀਂ ਸਾਰੇ ਹੀ ਰਲ ਕੇ ਇਸ ਵਿੱਚ ਅਤੇ ਅਸੀਂ ਦੌੜ ਲਾਉਂਦੇ ਹਾਂ ਅਤੇ ਆਪਣੇ ਸਰੀਰ ਨੂੰ ਫਿਟਨੈਸ ਰੱਖਦੇ ਹਾਂ ਅਤੇ ਹਾਸਾ ਮਖੌਲ ਕਰਦੇ ਕਰਦੇ ਅਸੀਂ ਸਾਰਿਆਂ ਭੈਣ ਭਰਾਵਾਂ ਨੂੰ ਨਾਲ ਰਲ ਕੇ ਹੋਰਾਂ ਨੂੰ ਵੀ ਨਾਲ ਪ੍ਰੇਰਿਤ ਕਰਦੇ ਹਾਂ ਭਈ ਤੁਸੀਂ ਦੌੜ ਲਾਇਆ ਕਰੋ ਇਹ ਤੁਹਾਡੀ ਸਿਹਤ ਵਾਸਤੇ ਸਰੀਰ ਵਾਸਤੇ ਸਭ ਤੋਂ ਵਧੀਆ ਫਿਟਨੈਸ ਅਤੇ ਸਭ ਤੋਂ ਵਧੀਆ ਚੀਜ਼ ਦੌੜ ਆ ਇਸ ਦੇ ਨਾਲ ਲਾਉਣ ਨਾਲ ਕਈ ਸਰੀਰ ਨੂੰ ਫਾਇਦੇ ਹੁੰਦੇ ਹਨ ਜਿਸ ਤਰ੍ਹਾਂ ਕਿ ਕੋਈ ਸਾਨੂੰ ਬਿਮਾਰੀ ਨਹੀਂ ਲੱਗਦੀ ਕੋਈ ਵੀ ਪੀ ਨਹੀਂ ਹੁੰਦਾ ਅਤੇ ਸਾਡੀ ਸਰੀਰ ਦੀ ਜਿਹੜੀ ਹੈ ਫਿਟਨੈਸ ਬਣੀ ਰਹਿੰਦੀ ਆ ਅਤੇ ਇਹਦੇ ਨਾਲ ਹਰ ਕਿਸੇ ਨੂੰ ਵੀ ਅਸੀਂ ਪ੍ਰੇਰਿਤ ਕਰਕੇ ਉਹਨਾਂ ਦਾ ਵੀ ਭਲਾ ਕਰਦੇ ਹਾਂ